ਸਮਾਜ ਵਿੱਚ ਤਕਨੋਲੋਜੀ ਦੇ ਵੱਧ ਰਹੇ ਪ੍ਰਭਾਵ ਬਾਰੇ ਮੈਂ ਦੱਸਣਾ ਚਾਹੁੰਦੀ ਹਾਂ ਕਿ ਚਿੰਤਾਵਾਂ ਦਾ ਅਤੇ ਬਹੁਤ ਚਿੰਤਾਵਾਂ ਵਧ ਵੱਧ ਰਹੀਆਂ ਹਨ ਦੇਖੋ ਜੀ ਪਹਿਲਾਂ ਤਾਂ ਇਹ ਚੀਜ਼ਾਂ ਮਤਲਬ ਤਕਨੋਲਜੀ ਨਹੀ ਹੁੰਦੀ ਏਸੀ ਨਹੀਂ ਸੀ ਹੁੰਦੇ ਮੋਬਾਇਲ ਨਹੀਂ ਸੀ ਹੁੰਦੇ ਤਾਂ ਟਾਵਰ ਵੀ ਨਹੀਂ ਸੀ ਹੁੰਦੇ ਤਾਂ ਅਸੀਂ ਮਤਲਬ ਵਧੀਆ ਜੀਵਨ ਜੀਂਦੇ ਸੀ ਤਾਜ਼ੀ ਹਵਾ 'ਚ ਸੌਂਦੇ ਸੀ ਆਰਾਮ ਨਾਲ ਕੋਈ ਬਿਮਾਰੀ ਨਹੀਂ ਕੋਈ ਕੁਛ ਨਹੀਂ ਜਲਦੀ ਨੀਂਦਰਾਂ ਖੁੱਲ੍ਹ ਜਾਂਦੀਆਂ ਸੀ ਤੜਕੇ ਸੁਵਖਤੇ ਉੱਠ ਜਾਂਦੇ ਸੀ ਅੱਜ ਕੱਲ੍ਹ ਦੇਖੋ ਏਸੀ ਥੱਲੇ ਸੋਂਦੇ ਹਾਂ ਅਤੇ ਸੋਵੋ ਅਤੇ ਸਵੇਰੇ ਸਰੀਰ ਜਾਮ ਹੋ ਜਾਂਦੇ ਉੇੱਠਿਆ ਨਹੀਂ ਜਾਂਦਾ ਕਿੰਨਾ ਮੁਸ਼ਕਿਲ ਹੈ ਔਰ ਬੱਚੇ ਇਹ ਦੇਖੋ ਮੋਬਾਇਲਾਂ 'ਚ ਲੱਗੇ ਰਹਿੰਦੇ ਮੋਬਾਈਲਾਂ ਦੀਆਂ ਜੀਬੀਆਂ ਵਧਾ ਤੀਆਂ ਉਹਨਾਂ ਨੇ ਟਾਵਰ ਟਾਵਰ ਅਲੱਗ ਲਗਾ ਤੇ ਆ ਅਤੇ ਦੇਖੋ ਟਾਵਰ ਕਿੰਨੇ ਲੱਗੇ ਅਤੇ ਉਹਦੇ ਨਾਲ ਜਿਹੜੀਆਂ ਪੰਛੀਆਂ ਨੂੰ ਕਿੰਨਾ ਨੁਕਸਾਨ ਹੋ ਰਿਹਾ ਵਿਚਾਰੇ ਪੰਛੀ ਕਈ ਚਿੜੀਆਂ ਤਾਂ ਸਾਡੀਆਂ ਛੋਟੀਆਂ ਛੋਟੀਆਂ ਚਿੜੀਆਂ ਕਿੰਨੀਆਂ ਸੋਹਣੀਆਂ ਆਉਂਦੀਆ ਸੀ ਪਹਿਲੇ ਉਹ ਤਾਂ ਲੁਪਤ ਹੋ ਗਈਆਂ ਨੇ ਨਜ਼ਰ ਹੀ ਨਹੀਂ ਆਉਂਦੀਆਂ ਵਿਚਾਰੀਆਂ ਟਾਵਰਾਂ ਨਾਲ ਉਹਨਾਂ ਦੀ ਰੇਂਜ ਹੋਰ ਕਈ ਕਾਂ ਹੁੰਦੇ ਸੀ ਪਹਿਲੇ ਉਹ ਤਾਂ ਉਹ ਵੀ ਲੁਪਤ ਹੋ ਗਏ ਉਹ ਵੀ ਨਜ਼ਰ ਨਹੀਂ ਆਉਂਦੇ ਉਹਨਾਂ ਕਰਕੇ ਉਹਨਾਂ ਉਹਨਾਂ ਨੂੰ ਵਿਚਾਰਿਆਂ ਨੂੰ ਉਹਨਾਂ ਦਾ ਜੀਵਨ ਖਤਮ ਹੋ ਗਿਆ ਉਹਨਾਂ ਦੀਆਂ ਪ੍ਰਭਾਵ ਪੰਛੀਆਂ ਜਾਨਵਰਾਂ 'ਤੇ ਬਹੁਤ ਪਿਆਰ ਹੈ ਔਰ ਦੇਖੋ ਜੀ ਪਹਿਲੇ ਤਾਂ ਅਸੀਂ ਜਿੱਦਾਂ ਮਰਜ਼ੀ ਗੁਜ਼ਾਰਾ ਕਰ ਲੈਂਦੇ ਸੀ ਏਸੀ ਨਹੀਂ ਹੈਗੇ ਸੋ ਜਾਂਦੇ ਸੀ ਦੇਖੋ ਅੱਜ ਕੱਲ੍ਹ ਦੇ ਬੱਚੇ ਮੁੜਦੇ ਹੀ ਨਹੀਂ ਏਸੀ ਦੇ ਬਗੈਰ ਸੋਣਾ ਨਹੀਂ ਔਰ ਸਵੇਰੇ ਉਹਨਾਂ ਕੋਲ ਉੱਠ ਨਹੀਂ ਹੁੰਦਾ ਸਕੂਲਾਂ ਤੋਂ ਲੇਟ ਸਰੀਰ ਉਹਨਾਂ ਦੇ ਜਾਮ ਨਾ ਲੱਤਾਂ ਤੁਰਦੀਆਂ ਨਾ ਬਾਵਾਂ ਤੁਰਦੀਆਂ ਬੜਾ ਹੀ ਔਖਾ ਹੋ ਗਿਆ ਅੱਜ ਕੱਲ੍ਹ ਪ੍ਰਭਾਵ ਵੈਸੇ ਤਾਂ ਦੇਖੋ ਜੀ ਹੁਣ ਐਹ ਜਿਹੜੇ ਅਸ ਤਕਲੋਜੀਆਂ ਚੱਲ ਪਈਆਂ ਨੇ ਸਾਨੂੰ ਸਾਰਿਆਂ ਨੂੰ ਨਾ ਇਹਦੀ ਆਦਤ ਪੈ ਗਈ ਆ ਹੈ ਅਸੀਂ ਇਹਨਾਂ ਨੂੰ ਬੰਦ ਤਾਂ ਨਹੀਂ ਕਰ ਸਕਦੇ ਪਰ ਐਹ ਹੈਗਾ ਅਸੀਂ ਇਹਨੂੰ ਘਟਾ ਸਕਦੇ ਹਾਂ ਕਿ ਇਹਦਾ ਥੋੜ੍ਹਾ ਜਿਹਾ ਅਸੀਂ ਅਗਰ ਮਨ ਨੂੰ ਆਪਣੇ ਆਪ 'ਤੇ ਕੰਟਰੋਲ ਕਰਦੇ ਹਾਂ ਸਾਰੇ ਇੱਕ ਦੂਜੇ ਨੂੰ ਸਮਝਾਨੇ ਹਾਂ ਕਿ ਬਈ ਏਸੀ ਘੱਟ ਲਾਓ ਚਲਾਓ ਜ਼ਿਆਦਾ ਤੋਂ ਜ਼ਿਆਦਾ ਪੱਖੇ ਥੱਲੇ ਸੌਣ ਦੀ ਕੋਸ਼ਿਸ਼ ਕਰੋ ਜ਼ਿਆਦਾ ਤੋਂ ਜ਼ਿਆਦਾ ਤੁਸੀਂ ਮਤਲਬ ਇੰਨੀਆਂ ਜ਼ਿਆਦਾ ਦੇਖੋ ਅਸੀਂ ਜ਼ਿਆਦਾ ਤੋਂ ਜ਼ਿਆਦਾ ਅਸੀਂ ਪੱਖੇ ਚਲਾਉਂਦੇ ਆ ਜਾਂ ਪੱਖੇ ਲੋਕੀ ਪਹਿਲਾਂ ਤਾਂ ਪੱਖੇ ਵੀ ਬੜੇ ਘੱਟ ਚਲਾਉਂਦੇ ਸੀ ਦੇਖੋ ਬਿਨਾਂ ਪੱਖਿਆਂ ਤੋਂ ਲੋਕ ਚਾਹ ਪੀਂਦੇ ਸੀ ਕਿ ਜੀ ਅਗਰ ਅਸੀਂ ਪੱਖਾ ਤੋਂ ਵਗੈਰਾ ਚਾਹ ਪੀਓਗੇ ਸਾਡਾ ਸਰੀਰ ਖੁੱਲ੍ਹ ਜੇਗਾ ਅੱਜ ਕੱਲ੍ਹ ਕਹਿੰਦੇ ਆ ਕਿ ਏਸੀ ਚਲਾਵਾਂਗੇ ਤਾਂ ਸਾਡਾ ਸਰੀਰ ਖੁੱਲੇਗਾ ਫਿਰ ਹੀ ਸਾਨੂੰ ਮਜ਼ਾ ਆਏਗਾ ਚਾਹ ਪੀਣ ਦਾ ਅੱਜ ਕੱਲ੍ਹ ਤਾਂ ਦੇਖੋ ਰਸੋਈਆਂ 'ਚ ਬਾਥਰੂਮ 'ਚ ਸਾਰੇ ਪਾਸੇ ਏਸੀ ਕੂਲਰ ਲਾ ਦਿੱਤੇ ਉਹਨਾਂ ਨੇ ਪਰ ਨਹੀਂ ਹੋਣਾ ਚਾਹੀਦਾ ਇਦਾਂ ਸਾਨੂੰ ਥੋੜ੍ਹਾ ਜਿਹਾ ਆਪਣੇ ਆਪ 'ਤੇ ਕਾਬੂ ਰੱਖਣਾ ਚਾਹੀਦਾ ਤਾਂ ਕਿ ਇਹਨਾਂ ਦੀਆਂ ਆਦਤਾਂ ਥੋੜ੍ਹੀਆਂ ਘਟਾਨੀਆਂ ਚਾਹੀਦੀਆਂ ਅਸੀਂ ਬੰਦ ਤਾਂ ਨਹੀਂ ਕਰ ਸਕਦੇ ਮੈਂ ਮੰਨਦੀ ਹਾਂ ਅਸੀਂ ਬਾ ਅਸੀਂ ਹੁਣ ਸਾਨੂੰ ਆਦਤ ਪੈ ਗਈ ਆ ਪਰ ਅਸੀਂ ਥੋੜ੍ਹਾ ਘਟਾ ਤਾਂ ਸਕਦੇ ਆ ਨਾ ਤਾਂ ਕਿ ਆਪਣੇ ਬੱਚਿਆਂ ਲਈ ਇਹਨੂੰ ਇਹੀ ਸਿਖਾਉਣਾ ਬੱਚਿਆਂ ਨੂੰ ਵੀ ਸਿਖਾਈਏ ਅਸੀਂ ਆਪ ਵੀ ਸਿੱਖੀਏ ਤਾਂ ਕਿ ਅਗਰ ਅਸੀਂ ਤੰਦਰੁਸਤ ਰਹਿਣਾ ਏ ਤਾ ਸਾਨੂੰ ਇਹ ਚੀਜ਼ਾਂ ਦਾ ਘੱਟ ਇਸਤੇਮਾਲ ਕਰਨਾ ਚਾਹੀਦਾ ਮੋਬਾਈਲਾਂ ਦਾ ਘੱਟ ਇਸਤੇਮਾਲ ਕਰਨਾ ਚਾਹੀਦਾ ਦੇਖੋ ਪਹਿਲਾਂ ਅੱਜ ਕੱਲ੍ਹ ਦੀਆਂ ਔਰਤਾਂ ਮੋਬਾਈਲਾਂ ਦੇ ਇੰਨੀਆਂ ਜੀਬੀਆਂ ਆਗੀਆਂ ਫਰੀ ਜੀਓ ਦੇ ਵਿੱਚ ਫਰੀ ਜੀਬੀ ਮਿਲ ਜਾਂਦੀ ਹੈ ਉਹ ਸਾਰਾ ਦਿਨ ਜਿਹੜੀਆਂ ਔਰਤਾਂ ਘਰ ਰਹਿੰਦੀਆਂ ਨੇ ਉਹ ਫੋਨ ਚਲਾਉਂਦੀਆਂ ਨੇ ਅਤੇ ਦੇਖੋ ਪਹਿਲੀਆਂ ਔਰਤਾਂ ਕੀ ਕਰਦੀਆਂ ਸੀ ਜਦੋਂ ਫ੍ਰੀ ਹੁੰਦੀਆਂ ਹੀ ਉਦੋਂ ਕਿਤਾਬਾਂ ਰਸਾਲੇ ਆਉਂਦੇ ਹੁੰਦੇ ਸੀ ਕੌਮਿਕਸ ਆਉਂਦੀਆਂ ਹੁੰਦੀਆਂ ਸੀ ਉਹ ਪੜ੍ਹਦੇ ਹੀ ਉਹਨਾਂ ਨਾਲ ਉਹਨਾਂ ਦਾ ਦਿਮਾਗ ਹੈ ਨਾ ਥੋੜ੍ਹਾ ਤੰ ਚੁਸਤ ਹੁੰਦਾ ਹੀ ਤੰਦ ਥੋੜ੍ਹੀ ਜਿਹੀ ਉਹਨਾਂ ਨੂੰ ਰੋਣਕ ਆਉਂਦੀ ਸੀ ਅਤੇ ਐਹ ਮੋਬਾਇਲਾਂ ਵਿੱਚ ਵੜ ਵੜ ਕੇ ਔਰਤਾਂ ਦੀ ਸ਼ ਸ਼ਕਲਾਂ ਦੀ ਰੌਣਕ ਹੀ ਖਤਮ ਹੋ ਗਈ ਹੈ ਬਸ ਦੇਖੋ ਕਿੰਨੀਆਂ ਟੈਕਨੋਲੋਜੀਆਂ ਐਹ ਨਹੀਂ ਅਸੀਂ ਕਹਿੰਦੇ ਕਿ ਟੈਕਨੋਲਜੀਆਂ ਘੱਟਣ ਘੱਟ ਜਾਣ ਜਾਂ ਬੰਦ ਹੋ ਜਾਣ ਸਾਡੇ ਕਹਿਣ ਨਾਲ ਕੁਛ ਨਹੀਂ ਹੋਣਾ ਕਿਉਂਕਿ ਟੈਕਨੋਲਜੀਆਂ ਦਿਨੋਂ ਦਿਨ ਵੱਧਣੀਆਂ ਨੇ ਹੁਣ ਜਿਵੇਂ ਦੇਖੋ ਐਹ ਅੱਜ ਕੱਲ੍ਹ ਤਾਂ ਸੜਕਾਂ 'ਤੇ ਗੱਡੀਆਂ ਚੱਲਦੀਆਂ ਨਾ ਹੁਣ ਅੱਗੋਂ ਜਾ ਕੇ ਪਤਾ ਨਹੀਂ ਕੁਛ ਸਾਲਾਂ ਬਾਅਦ ਅਸਮਾਨ 'ਤੇ ਗੱਡੀਆਂ ਚੱਲਣੀਆਂ ਸ਼ੁਰੂ ਹੋਣੀਆਂ ਇੰਨੀਆਂ ਟੈਕਨੋਲਜੀਆਂ ਵੱਧ ਜਾਣੀਆਂ ਔਰ ਬੰਦਿਆਂ ਨੇ ਤਾਂ ਇਹ ਕੰਮ ਕਰਨ ਦੀ ਲੋੜ ਹੀ ਨਹੀਂ ਪੈਣੀ ਉੱਥੇ ਤਾਂ ਰੋਬਟ ਲੱਗ ਚੱਲ ਪਏ ਨੇ ਕਿੰਨਾ ਜ਼ਿਆਦਾ ਉਹਨਾਂ ਲਈ ਦੇਖੋ ਉਸ ਤੋਂ ਬਾਅਦ ਰੋਬਟ ਕੀ ਮਸ਼ੀਨਾਂ ਡਿਲੀਵਰੀਆਂ ਮਸ਼ੀਨਾਂ ਨਾਲ ਹੋਣੀਆਂ ਉਹਨਾਂ ਦੇ ਨਾਲ ਬਸ ਥੋੜ੍ਹਾ ਜਿਹਾ ਸਾਨੂੰ ਘਟਾਉਣਾ ਚਾਹੀਦਾ ਜ਼ਿਆਦਾ ਅਸੀਂ ਨਹੀਂ ਘਟਾ ਸਕਦੇ ਪਰ ਥੋੜ੍ਹਾ ਜਿਹਾ ਆਪਣੇ ਆਪ ਨੂੰ ਕਾਬੂ ਕਰਨਾ ਚਾਹੀਦਾ